ਮੈਂ ਆਪਣੀ ਲਿਖਤ ਦੂਸਰਿਆਂ ਨਾਲੋਂ ਵੱਖਰੀ ਮੰਨਦਾ ਹਾਂ ਕਿਉਂਕਿ ਬਹੁਤ ਸਾਰੇ ਲੇਖਕ ਹੈ ਜਿਹੜੇ ਆਮ ਵਿਸ਼ਿਆਂ ਨੂੰ ਛੂੰਹਦੇ ਹੈ ਮੈਂ ਜਦੋਂ ਵੀ ਲਿਖਿਆ ਤਾਂ ਵਿਸ਼ੇਸ਼ ਤੌਰ 'ਤੇ ਸਮਾਜਿਕ ਵਿਸ਼ਿਆਂ ਨੂੰ ਟੱਚ ਕੀਤਾ ਜਿਹਦੇ ਵਿੱਚ ਮਜ਼ਦੂਰਾਂ ਦੀ ਗੱਲ ਹੋਈ ਕੋਈ ਮਜ਼ਦੂਰ ਔਰਤ ਦੀ ਗੱਲ ਹੋਈ ਕੰਨਿਆ ਭਰੂਣ ਹੱਤਿਆ ਦੀ ਗੱਲ ਹੋਈ ਨਸ਼ਿਆਂ ਦੀ ਗੱਲ ਹੋਈ ਬਹੁਤ ਸਾਰੇ ਇਹੋ ਜਿਹੇ ਟੌਪਕ ਆ ਜਿਹਨਾਂ ਨੂੰ ਕਈ ਲੋਕ ਛੂੰਹਦੇ ਨਹੀਂ ਆ ਮੈਂ ਇਸ ਗੱਲ ਨੂੰ ਵੀ ਛੂਹਿਆ ਕਿ ਮੀਂਹ ਨਾ ਪਾਵੀਂ ਰੱਬਾ ਮੇਰਾ ਕੋਠਾ ਕਮਜ਼ੋਰ ਏ ਕਿਉਂਕਿ ਲੋਕ ਜ਼ਿਆਦਾਤਰ ਰੋਮਾਂਟਿਕ ਲਿਖਦੇ ਆ ਅਤੇ ਬਹੁਤ ਸਾਰੇ ਇਹੋ ਜਿਹੇ ਲੇਖਕ ਵੀ ਆ ਜਿਹੜੇ ਸਿਰਫ ਰੋਮਾਂਟਿਕ ਏ ਲਿਖਦੇ ਆ ਉਹ ਸਮਾਜਿਕ ਵਿਸ਼ੇ ਨੂੰ ਛੂੰਹਦੇ ਨਹੀਂ ਇਸ ਕਰਕੇ ਮੇਰਾ ਜਿਹੜੀ ਦੂਸਰਿਆਂ ਲੇਖਕਾਂ ਤੋਂ ਬਿਲਕੁਲ ਜਿਹੜੀ ਲਿਖਣੀ ਆ ਉਹ ਬਿਲਕੁਲ ਵੱਖਰੀ ਹੈ ਹਾਂ ਕੁਝ ਕੁ ਚੀਜ਼ਾਂ ਨੂੰ ਮੈਂ ਸੁਧਾਰਨਾ ਚਾਹਵਾਂਗਾ ਕਿਉਂ ਜਿਹੜੀਆਂ ਚੀਜ਼ਾਂ ਮੇਰੇ ਵੱਸ ਵਿੱਚ ਨਹੀਂ ਹੈ ਉਹਨਾਂ ਨੂੰ ਮੈਂ ਸੁਧਾਰਨ ਲਈ ਦੂਸਰੇ ਲੇਖਕਾਂ ਦੀ ਮਦਦ ਵੀ ਲੈ ਸਕਦਾਂ ਔਰ ਕਈ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੇ ਰੋਮਾਂਟਿਕ ਵਿਸ਼ੇ ਜੇ ਮੈਂ ਛੂਹੇ ਵੀ ਆ ਉਹਨਾਂ ਰੋਮਾਂਟਿਕ ਵਿਸ਼ਿਆਂ ਦੇ ਵਿੱਚ ਵੀ ਮੈਂ ਜੇ ਔਰਤ ਦੀ ਗੱਲ ਕੀਤੀ ਆ ਤਾਂ ਉਹਦੇ ਵਿੱਚ ਸੁਧਾਰਵਾਦੀ ਜਿਹੜੇ ਸ਼ਬਦ ਹੈ ਉਹ ਮੈਂ ਪਾਏ ਹੈ ਔਰ ਅੱਗੇ ਤੋਂ ਵੀ ਜਿਹੜੇ ਹੈ ਉਹ ਸੁਧਾਰਵਾਦੀ ਸ਼ਬਦ ਪਾ ਕੇ ਉਹਦੇ ਵਿੱਚ ਮੈਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਸੁਧਾਰ ਕਰ ਸਕਦਾਂ ਅਤੇ ਮੇਰੀ ਹੋਰ ਵੀ ਲੇਖਣੀ ਜਿਹੜੀ ਉਹ ਵਧੀਆ ਹੋ ਸਕਦੀ ਆ ਇਸ ਕਰਕੇ ਜਿਹੜੇ ਆਮ ਲੇਖਕ ਹੈ ਉਹਨਾਂ ਨਾਲ਼ੋਂ ਮੇਰਾ ਲਿਖਣ ਦਾ ਵਿਸ਼ਾ ਉਹ ਵੱਖਰਾ ਹੀ ਹੈ